ਮੈਂ ਐਮਾਜੌਨ ਤੋਂ ਸ਼ੋਪਿੰਗ ਕਰਦਾ ਹਾਂ ਅਤੇ ਐਮਾਜੌਨ ਤੋਂ ਇੱਕ ਪ੍ਰਿੰਟਰ ਮੰਗਵਾਇਆ ਜੋ ਕਿ ਬਹੁਤ ਹੀ ਵਧੀਆ ਨਿਕਲਿਆ ਉਹਦੀ ਇੰ ਮੈਂ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਪ੍ਰਿੰਟਰ ਮੰਗਵਾਏ ਹੋਏ ਨੂੰ ਉਹਦੀ ਇੰਕ ਵੀ ਅਜੇ ਤੱਕ ਖ਼ਤਮ ਨਹੀਂ ਹੋਈ ਔਰ ਉਸਦੇ ਪੇਚ ਵੀ ਬਹੁਤ ਵਧੀਆ ਨਿਕਲਦੇ ਹਨ ਕਦੇ ਵੀ ਅੜੇ ਫਸੇ ਨਹੀਂ ਐਮਾਜੌਨ ਤੋਂ ਜੋ ਡਿਲੀਵਰੀ ਦਾ ਸਮਾਂ ਸਾਨੂੰ ਦਿੱਤਾ ਜਾਂਦਾ ਹੈ ਉਸ ਤੋਂ ਵੀ ਇੱਕ ਦੋ ਦਿਨ ਪਹਿਲਾਂ ਸਾਡਾ ਸਮਾਨ ਸਾਡੇ ਤੱਕ ਪਹੁੰਚਾ ਦਿੱਤਾ ਜਾਂਦਾ ਹੈ ਉਸ ਐਮਾਜੌਨ ਦੇ ਡਿਲੀਵਰੀ ਜੋ ਕਰਨ ਬੋਆਏ ਆਉਂਦੇ ਹਨ ਉਹ ਵੀ ਬਹੁਤ ਵਧੀਆ ਉਹਨਾਂ ਦਾ ਵਿਹਾਰ ਹੈ ਬੋਲਣ ਬਹੁਤ ਵਧੀਆ ਹੈ ਉਹ ਸਾਡੇ ਨਾਲ ਬਹੁਤ ਵਧੀਆ ਡੀਲਿੰਗ ਕਰਦੇ ਆ ਔਰ ਕੋਈ ਵੀ ਇਸ ਤਰ੍ਹਾਂ ਦੀ ਸਾਨੂੰ ਕਦੇ ਵੀ ਕੋ ਕੋਈ ਕੰਪਲੇਂਟ ਨਹੀਂ ਆਈ ਜੋ ਵੀ ਸਮਾਂ ਸਾਨੂੰ ਦਿੱਤਾ ਜਾਂਦਾ ਹੈ ਨਿਰਧਾਰਿਤ ਸਮੇਂ ਤੋਂ ਵੀ ਦੋ ਚਾਰ ਦਿਨ ਪਹਿਲਾਂ ਸਾਡੀ ਡਿਲੀਵਰੀ ਸਾਨੂੰ ਪਹੁੰਚਾ ਦਿੱਤੀ ਜਾਂਦੀ ਹੈ ਔਰ ਕਦੇ ਵੀ ਕਿਸੇ ਤਰ੍ਹਾਂ ਦੀ ਕੰਪਲੇਂਟ ਸਾਨੂੰ ਐਮਾਜੌਨ ਤੋਂ ਕੋਈ ਵੀ ਸ਼ਿਕਾਇਤ ਨਹੀਂ ਹੈ